ਸਾਡੇ ਬ੍ਰਹਿਮੰਡ ਵਿੱਚ ਕਿੰਨੀਆਂ ਹੀ ਗੈਲੈਕਸੀਜ ਹਨ ਕਿੰਨੀਆਂ ਹੀ ਕਿੰਨੇ ਹੀ ਗ੍ਰਹਿ ਹਨ ਕਿੰਨੇ ਹੀ ਤਾਰੇ ਹਨ ਪਰ ਜਿਹੜੇ ਜਿਹੜੇ ਗ੍ਰਹਿ ਜਿਹੜੀ ਜਿਹੜੀ ਗੈਲਕਸੀ ਵਿੱਚ ਅਸੀਂ ਰਹਿੰਦੇ ਹਾਂ ਉਸਦਾ ਨਾ ਮਿਲਕੀ ਵੇ ਗਲੈਕਸੀ ਹੈ ਅਤੇ ਜਿਸ ਗ੍ਰਹਿ 'ਤੇ ਅਸੀਂ ਰਹਿੰਦੇ ਹਾਂ ਉਸਦਾ ਨਾਮ ਅਰਥ ਹੈ ਸਾਡੇ ਗੈਲਕਸੀ ਵਿੱਚ ਕਿੰਨੇ ਹੀ ਪਲੈਨਟਸ ਹਨ ਜਿਵੇਂ ਕਿ ਮਾਰਸ ਜੁਪਿਟਰ ਸੈਟਰਨ ਜਾਂ ਫਿਰ ਵੀਨਸ ਹੋਵੇ ਵੀਨਸ ਜਿਸ ਨੂੰ ਸਿਸਟਰ ਆਫ ਅਰਥ ਵੀ ਕਿਹਾ ਜਾਂਦਾ ਜਾਂ ਫਿਰ ਮਾਰਸ ਹੋਵੇ ਜਿਸ ਨੂੰ ਰੈਡ ਪਲੈਨਟ ਕਿਹਾ ਜਾਂਦਾ ਹੈ ਚਾਹੇ ਸੈਟਰਨ ਹੋਵੇ ਸੈਟਰਨ ਦੇ ਕਿੰਨੇ ਬੀਟਫੁਲ ਰਿੰਗਜ਼ ਹੁੰਦੀਆਂ ਉਸ ਦੇ ਆਲੇ ਦੁਆਲੇ ਜਾਂ ਫਿਰ ਜੂਪੀਟਰ ਹੋਵੇ ਜਿਹੜਾ ਸਭ ਤੋਂ ਵੱਡਾ ਪਲੈਨਟ ਜਿਹੜਾ ਸਭ ਤੋਂ ਵੱਡਾ ਪਲੈਨਟ ਹੈ ਮ ਮਿਲਕੀ ਵੇ ਗਲੈਕਸੀ ਵਿੱਚ ਜਾਂ ਫਿਰ ਉਸ ਦੇ ਨਾਲ ਯੂਰੇਨਸ ਹੋਵੇ ਨੈਪਚੁਨ ਹੋਵੇ ਯੂਰੇਨਸ ਨੂੰ ਸਭ ਤੋਂ ਠੰਡਾ ਗ੍ਰਹਿ ਮੰਨਿਆ ਜਾਂਦਾ ਹੈ ਪਰ ਮੇਰਾ ਫੇਵਰਟ ਜਿਹੜਾ ਮੇਰਾ ਸਭ ਤੋਂ ਮਨਪਸੰਦੀਦਾ ਗ੍ਰਹਿ ਹੈ ਜਿਸ 'ਤੇ ਅਸੀਂ ਰਹਿੰਦੇ ਹਾਂ ਧਰਤੀ ਧਰਤੀ ਧਰਤੀ ਕਾਹ ਤੋਂ ਕਿਉਂਕਿ ਇਸ 'ਤੇ ਸਾਰੇ ਸੋਰਸ ਹਨ ਇਸ 'ਤੇ ਇੱਕ ਜੀਵਨ ਉਪਲਬਧ ਹੈ ਹਜੇ ਤੱਕ ਹਜੇ ਤੱਕ ਵਿਗਿਆਨੀਆਂ ਦੇ ਅਨੁਸਾਰ ਮੈਂ ਜਿਸ 'ਤੇ ਕੋਈ ਜੀਵ ਜੋ ਰਹਿ ਰਿਹਾ ਇਹਨਾਂ ਸਾਰੇ ਪਲੈਨਟਸ ਵਿੱਚ ਤਾਂ ਉਹ ਧਰਤੀ ਹੀ ਹੈ ਜਿੱਥੇ ਪਾਣੀ ਵੀ ਹੈ ਹਵਾ ਹੈ ਧਰਤੀ ਜਿੱਥੇ ਕਿੰਨੇ ਖੂਬਸੂਰਤ ਪੌਦੇ ਹਨ ਫੁੱਲ ਹਨ ਜਿੱਥੇ ਜੀਵਨ ਸੰਭਵ ਹੈ ਜਿੱਥੇ ਇਨਸਾਨ ਰਹਿੰਦਾ ਹੈ ਜਿੱਥੇ ਅਸੀਂ ਰਹਿੰਦੇ ਹਾਂ ਅ ਅਕਸਰ ਆਪਾਂ ਸਭ ਨੂੰ ਹੀ ਪਤਾ ਹੈ ਜਿੱਥੇ ਆਪਾਂ ਜਿੰਨਾਂ ਮਰਜ਼ੀ ਚੰਗੇ ਤੋਂ ਚੰਗੇ ਦੇਸ਼ ਸ਼ਹਿਰ ਚਲੇ ਜਾਈਏ ਪਰ ਹਮੇਸ਼ਾ ਸਕੂਨ ਜਿਹੜਾ ਹੈ ਉਹ ਆਪਦੇ ਘਰ ਆ ਕੇ ਹੀ ਮਿਲਦਾ ਹੈ ਉਸੇ ਤਰ੍ਹਾਂ ਧਰਤੀ ਹੀ ਮੇਰਾ ਮੇਰਾ ਮਨਪਸੰਦੀਦਾ ਗ੍ਰਹਿ ਹੈ ਕਿਉਂਕਿ ਓਥੇ ਕਿੰਨੇ ਤਰ੍ਹਾਂ ਦੇ ਜੀਵ ਹਨ ਇਨਸਾਨ ਹਨ ਇਨਸਾਨ ਦੇ ਨਾਲ ਜਾਨਵਰ ਹਨ ਕੁੱਤੇ ਕੁੱਤੇ ਹੋਗੇ ਬਿੱਲੀਆਂ ਹੋ ਗਈਆਂ ਜਾਂ ਫਿਰ ਕਿੰਨੇ ਤਰ੍ਹਾਂ ਦੇ ਪਕਸ਼ੀ ਹੋ ਗਏ ਪੰਛੀ ਹੋ ਗਏ ਜਿਹੜੇ ਆਪਣੇ ਜਿੰਦਗੀ ਜੋ ਹੈ ਜਿਉਂਦੇ ਹਨ ਇਸ ਇਸ ਸਵਰਗ ਅਤੇ ਇਸਨੂੰ ਕਹਿ ਦਈਏ ਤਾਂ ਧਰਤੀ 'ਤੇ ਹੀ ਸਵਰਗ ਹੈ ਉਸੇ ਤਰ੍ਹਾਂ ਮੇਰਾ ਮਨਪਸੰਦੀਦਾ ਗ੍ਰਹਿ ਧਰਤੀ ਹੈ